ਸ ਹਾਂਜੀ ਸਰੀਰਿਕ ਕਸਰਤ ਅਤੇ ਯੋਗਾ ਵਿੱਚ ਕਾਫ਼ੀ ਅੰਤਰ ਹੈ ਇਹ ਦੋਨੋਂ ਇੱਕ ਦੂਜੇ ਤੋਂ ਵੱਖ ਵੱਖ ਨੇ ਪਰ ਇਨ੍ਹਾਂ ਦਾ ਜਿਹੜਾ ਬੈਨੀਫਿਟ ਹੈ ਉਹ ਇੱਕ ਹੀ ਹੈ ਜਿਵੇਂ ਹੁਣ ਸਰੀਰਿਕ ਕਸਰਤ ਦੀ ਆਪਾਂ ਗੱਲ ਕਰੀਏ ਸਰੀਰਿਕ ਕਸਰਤ ਜਿਵੇਂ ਹੁਣ ਖੇਤੀਬਾੜੀ ਕਰਦੇ ਨੇ ਕਿਸਾਨ ਉਹ ਖੇਤੀਬਾੜੀ ਸਾਰਾ ਦਿਨ ਹਲ ਚਲਾਉਂਦੇ ਨੇ ਠੀਕ ਹੈ ਕ ਕਹੀਆਂ ਚਲਾਉਂਦੇ ਨੇ ਕਦੇ ਪਾਣੀ ਲਗਾਤਾ ਕਦੇ ਵੱਟਾਂ ਪਾ ਲਈਆਂ ਇਸ ਨਾਲ ਉਨ੍ਹਾਂ ਦੀ ਬਾਹਾਂ ਦੀ ਕਸਰਤ ਹੁੰਦੀ ਰਹਿੰਦੀ ਹੈ ਠੀਕ ਹੈ ਉਹ ਕਦੇ ਵੀ ਉਰੇ ਪਰੇ ਜਾਂਦੇ ਨੇ ਕੋਈ ਕੰਮ ਕਰਦੇ ਨੇ ਹਰ ਥਾਂ ਜਿਵੇਂ ਹੁਣ ਮੰਨ ਲਉ ਕੋਈ ਗਰੀਬ ਨੇ ਜਿਵੇਂ ਲੋਕ ਉਹ ਸਾਈਕਲ 'ਤੇ ਚੌਵੀ ਘੰਟੇ ਇੱਧਰੋਂ ਚਲੇ ਗਏ ਓਧਰ ਚਲੇ ਗਏ ਇਨ੍ਹਾਂ ਨੇ ਉਸ ਸਾਈਕਲ ਨਾਲ ਉਨ੍ਹਾਂ ਦੀ ਕਸਰਤ ਹੁੰਦੀ ਰਹਿੰਦੀ ਹੈ ਅਤੇ ਜਿਹੜੀ ਮੰਨ ਲਉ ਲੇਡੀਜ ਹੁੰਦੀਆਂ ਨੇ ਜੋ ਉਸ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੀਆਂ ਨੇ ਜਿਵੇਂ ਝਾੜੂ ਪੋਚਾ ਕਰ ਲਿਆ ਰੋਟੀ ਬਣਾ ਲਈ ਕੱਪੜੇ ਧੋ ਲਏ ਭਾਂਡੇ ਮਾਂਜ ਲਏ ਇਸ ਉਨ੍ਹਾਂ ਦੀ ਵੀ ਕਸਰਤ ਹੁੰਦੀ ਰਹਿੰਦੀ ਹੈ ਅਤੇ ਬੱਟ ਜਿਹੜਾ ਯੋਗਾ ਗਾ ਉਹ ਉਹਦੇ 'ਚ ਅਲੱਗ ਅੰਤਰ ਹੈ ਜਿਵੇਂ ਯੋਗਾ ਹੁਣ ਮੰਨ ਲਉ ਹੁਣ ਆਪਾਂ ਕਿਸੇ ਪਾਰਕ 'ਚ ਜਾਨੇ ਹਾਂ ਉੱਥੇ ਆਪਾਂ ਬਹਿ ਕੇ ਯੋਗਾ ਕਰਦੇ ਹਾਂ ਤਾਂ ਉਹਦੇ ਨਾਲ ਆਪਣਾ ਮਾਈਂਡ ਹੈ ਜਿਹੜਾ ਉਹ ਵੀ ਫਰੈਸ਼ ਹੁੰਦਾ ਹੈ ਕਿਉਂਕੀ ਆਪਣਾ ਜਿਹੜਾ ਧਿਆਨ ਸਿਰਫ ਯੋਗਾ 'ਤੇ ਹੀ ਹੁੰਦਾ ਆਪਣਾ ਮਨ ਸਿਰਫ਼ ਇੱਕ ਤਰਫਾ ਹੁੰਦਾ ਹੈ ਨਾ ਆਪਾਂ ਇੱਧਰ ਦੇਖਦੇ ਹਾਂ ਨਾ ਉੱਧਰ ਅਤੇ ਆਪਾਂ ਐਕਸਰਸਾਈਜ ਆਪਦੀ ਪ੍ਰੋਪਰ ਕਰਦੇ ਹਾਂ ਆਪਾਂ ਨੂੰ ਐਂ ਹੁੰਦਾ ਵੀ ਆਪਾਂ ਯੋਗਾ ਸ ਕਰ ਰਹੇ ਹਾਂ ਤਾਂ ਆਪਾਂ ਯੋਗਾ 'ਤੇ ਹੀ ਧਿਆਨ ਦਈਏ ਕਿਸੇ ਉਰੇ ਪਰੇ ਨਾ ਗੱਲ ਕਰੀਏ ਇਹ ਨਾ ਆਪਣਾ ਸਰੀਰ ਦਾ ਵੀ ਵੇਟ ਲੋਸ ਹੁੰਦਾ ਹੈ ਆਪਾਂ ਨੂੰ ਕਾਫ਼ੀ ਹੋਰ ਵੀ ਬੈਨੀਫਿਟਸ ਹੁੰਦੇ ਆ ਇਚ ਇਹਦੇ ਨਾਲ ਆਪਾਂ ਨੂੰ ਸਾਹ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਾਂ ਜਦੋਂ ਆਪਾਂ ਬਹਿਨੇ ਹਾਂ ਤਾਂ ਆਪਾਂ ਉੱਥੇ ਆਪਾਂ ਸੁਆਸ ਰਾਹੀਂ ਵੀ ਆਪਾਂ ਕਸਰਤ ਯੋਗਾ ਕਰਦੇ ਹਾਂ ਜੇ ਆਪਾਂ ਖੜੇ ਹੋ ਕੇ ਵੀ ਕਰਦੇ ਹਾਂ ਆਪਾਂ ਬੈਠ ਕੇ ਵੀ ਮਨ ਇੱਕ ਚਿੱਤ ਹੋ ਕੇ ਕਰਦੇ ਹਾਂ ਤਾਂ ਕਿ ਆਪਾਂ ਨੂੰ ਆਪਣੀ ਮੈਡੀਟੇਸ਼ਨ ਵਧੀਆ ਰਹੇ ਇਹਦੇ ਨਾਲ ਯੋਗਾ ਨਾਲ ਇਹ ਹੁੰਦਾ ਵੀ ਆਪਣਾ ਜਿਹੜਾ ਮਾਈਂਡ ਆ ਉਹ ਫਰੈਸ਼ ਰਹਿੰਦਾ ਹੈ ਇੱਕ ਇਹਦੇ ਨਾਲ ਐਂ ਵੀ ਆਪਾਂ ਪਾਰਕ 'ਚ ਜਾ ਕੇ ਲੋਕਾਂ ਨੂੰ ਵੀ ਦੇਖਦੇ ਹਾਂ ਵੀ ਉਹ ਕਿਸ ਤਰ੍ਹਾਂ ਯੋਗਾ ਕਰਦੇ ਆ ਅੱਜ ਕੱਲ੍ਹ ਤਾਂ ਕਾਫ਼ੀ ਲੋਕ ਯੋਗਾ ਜੋਆਇਨ ਵੀ ਕਰ ਰਹੇ ਨੇ ਕਲਾਸਿਜ ਲੈ ਰਹੇ ਨੇ ਪਰ ਇਹਦਾ ਕੋਈ ਇੰਨਾ ਬੈਨੀਫਿਟ ਨਹੀਂ ਜਿੰਨਾਂ ਆਪਾਂ ਲਈ ਸਰੀਰਿਕ ਕਸਰਤ ਦਾ ਹੈ